ਵੀਰ ਜੀ ਮੇਰੀ ਜਿੰਨੀ ਕੁ ਤਨਖਾਹ ਆਉਂਦੀ ਹੈ ਉਹ ਸਾਰੀ ਹੀ ਲੱਗ ਜਾਂਦੀ ਹੈ ਜ਼ਿਆਦਾਤਰ ਮੇਰੀ ਤਨਖਾਹ ਮੇਰੇ ਮੋਬਾਈਲ ਪਲੈਨ ਉੱਤੇ ਲੱਗਦੀ ਹੈ ਇਸ ਲਈ ਮੈਂ ਸੋਚਦੀ ਹਾਂ ਕਿ ਆਪਣੇ ਮੋਬਾਈਲ ਪਲੈਨ ਵਿੱਚ ਥੋੜ੍ਹੀ ਜਿਹੀ ਕਟੌਤੀ ਕਰਕੇ ਥੋੜ੍ਹੇ ਕੁ ਪੈਸੇ ਬਚਾਏ ਜਾਣ ਜਿਸ ਕਰਕੇ ਮੈਨੂੰ ਆਪਣੇ ਖਰਚਿਆਂ ਵਿੱਚ ਥੋੜ੍ਹੀ ਜਿਹੀ ਸਹਾਇਤਾ ਮਿਲੇਗੀ ਜਿਸ ਕਾਰਨ ਮੈਂ ਆਪਣੇ ਖਰਚਿਆਂ ਨੂੰ ਘੱਟ ਕਰ ਸਕਾਂਗੀ ਕੀ ਤੁਸੀਂ ਸਹੀ ਸਮਝਦੇ ਹੋ ਕਿ ਮੈਨੂੰ ਇੱਦਾਂ ਕਰਨਾ ਚਾਹੀਦਾ ਹੈ ਕਿਉਂਕਿ ਮੇਰੇ ਜ਼ਿਆਦਾਤਰ ਖ਼ਰਚੇ ਮੇਰੀ ਮੋਬਾਈਲ ਯੋਜਨਾ ਉੱਤੇ ਹੀ ਲੱਗ ਰਹੇ ਹਨ ਕਿਉਂਕਿ ਮੈਨੂੰ ਕਾਫ਼ੀ ਹਿੱਸਾ ਆਪਣਾ ਤਨਖਾਹ ਦਾ ਇਨ੍ਹਾਂ ਮੋਬਾਈਲ ਯੋਜਨਾਵਾਂ ਉੱਤੇ ਲਾਉਣਾ ਪੈਂਦਾ ਹੈ ਜਿਸ ਕਾਰਨ ਮੈਨੂੰ ਬਹੁਤ ਹੀ ਸਮੱਸਿਆਵਾਂ ਦਾ ਸਾਮਣਾ ਕਰਨਾ ਜ ਪੈਂਦਾ ਹੈ